ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਮਨੋਰੰਜਨ ਦੇ ਸਭ ਤੋਂ ਪ੍ਰਸਿੱਧ ਰੂਪ ਵਿੱਚ ਭੰਗੜਾ ਗਿੱਧਾ ਹੈ ਜੋ ਕਿ ਬਹੁਤ ਹੀ ਮੰਨਿਆ ਪ੍ਰਮੰਨਿਆ ਪੰਜਾਬ ਦਾ ਹੈ ਅ ਭੰਗੜਾ ਜਿਹੜੇ ਗੱਭਰੂ ਜਵਾਨ ਜੋ ਭੰਗੜਾ ਪਾਉਂਦੇ ਹਨ ਅਤੇ ਉਹਦੀ ਪ੍ਰਸਿੱਧੀ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੱਕ ਵੀ ਇਹ ਫੈਲੀ ਹੈ ਮੁਟਿਆਰਾਂ ਜੋ ਉਹ ਗਿੱਧਾ ਪਾਉਂਦੀਆਂ ਹਨ ਇਸਤੋਂ ਇਲਾਵਾ ਮਨੋਰੰਜਨ ਦੇ ਕਈ ਸਾਧਨ ਹਨ ਜਿਵੇਂ ਖੇਡਾਂ ਕਬੱਡੀ ਅ ਹਾਕੀ ਇਹ ਪੰਜਾਬ ਦੀਆਂ ਪ੍ਰਸਿੱਧ ਖੇ ਖੇਡਾਂ ਹਨ ਇਸ ਤੋਂ ਇਲਾਵਾ ਪੰਜਾਬ ਵਿੱਚ ਨਾਟਸ਼ਾਲਾ ਵੀ ਹੈ ਜਿੱਥੇ ਨਾਟਕ ਲਿਖੇ ਜਾਂਦੇ ਹਨ ਅਤੇ ਉਹ ਰਚੇ ਵੀ ਜਾਂਦੇ ਹਨ ਇਹ ਅੰਮ੍ਰਿਤਸਰ ਦੇ ਖਾਲਸਾ ਕੋਲਜ ਦੇ ਸਾਹਮਣੇ ਇਹ ਨਾਟਸ਼ਾਲਾ ਹੈ ਖ਼ਾਸ ਕਰਕੇ ਇੱਥੇ ਇਹ ਨਾਟਕ ਤਿਆਰ ਕੀਤੇ ਜਾਂਦੇ ਹਨ ਅਤੇ ਬਣਾਏ ਜਾਂਦੇ ਹਨ ਹੋਰ ਪੰਜਾਬ ਵਿੱਚ ਮਨੋਰੰਜਨ ਦੇ ਸਾਧਨ ਜਿਵੇਂ ਗੱਤਕਾ ਗਰੁੱਪ ਹੁੰਦੇ ਹਨ ਜਿੱਥੇ ਬੱਚੇ ਗੱਤਕਾ ਸਿੱਖਦੇ ਹਨ ਖੇਡਦੇ ਹਨ ਅਤੇ ਹੋਰ ਮ ਮਨੋਰੰਜਨ 'ਚ ਪੰਜਾਬ ਵਿੱਚ ਹਾਕੀ ਬਹੁਤ ਪ੍ਰਸਿੱਧ ਹੈ ਜੋ ਕਿ ਪੰਜਾਬ ਦੇ ਬੱਚੇ ਜਿਹੜੇ ਨੇ ਹੇ ਇਹ ਇਸ ਖੇ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਗਈ ਹੈ ਔਰ ਕਬੱਡੀ ਪੰਜਾਬ ਦੀ ਬਹੁਤ ਮਸ਼ਹੂਰ ਮੰਨੀ ਜਾਂਦੀ ਹੈ ਜੋ ਕਿ ਬਹੁਤ ਹੀ ਉੱਚੇ ਪੱਧਰ ਤੱਕ ਇਸਨੂੰ ਸਥਾਨ ਪ੍ਰਾਪਤ ਹੋਇਆ ਹੈ ਹੋਰ ਪੰਜਾਬ ਦੇ ਮਨੋਰੰਜਨ ਦੀਆਂ ਖੇਡਾਂ ਗੁੱਲੀ ਡੰਡਾ ਹੋ ਗਿਆ ਜੋ ਕਿ ਆਮ ਪਿੰਡ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਮਨੋਰੰਜਨ ਲਈ ਜਿਵੇਂ ਬੱਚੇ ਕਾਂਚੇ ਅ ਉਹ ਖੇਡਦੇ ਹਨ ਹੋਰ ਪ ਪੁਰਾਤਨ ਪੰਜਾਬੀ ਜਿਹੜੀਆਂ ਸੀ ਇਹ ਇਹ ਸਾਰੀਆਂ ਖੇਡਾਂ ਸਨ ਜੋ ਕਿ ਬਹੁਤ ਹੀ ਪ੍ਰਸਿੱਧ ਸਨ ਅਤੇ ਪੰਜਾਬ ਇਹ ਇਸਦੇ ਨਾਲ ਨਾਲ ਪੰਜਾਬ ਜੋ ਹੈ ਉਹ ਸਿਹਤ ਪੱਖੀ ਵੀ ਇਹਨਾਂ ਚ ਖੇਡਾਂ ਨਾਲ ਵਿਕਾਸ ਹੁੰਦਾ ਸੀ